ਸ਼ਾਰਕ ਟੈਂਕ ਸ਼ਾਰਕ ਟੈਂਕ ਤੋਂ ਬਿਲਕੁਲ ਸਹੀ ਤਰੀਕੇ ਨਾਲ ਚੰਗੀ ਤਰ੍ਹਾਂ ਜਾਣਦੇ ਹਾਂ ਸ਼ਾਰਕ ਟੈਂਕ ਕੀ ਹੈ ਸ਼ਾਰਕ ਟੈਂਕ ਕੁਛ ਬਿਜਨਸਮੈਨ ਬੰਦਿਆਂ ਦਾ ਟੋਲਾ ਹੈ ਜਿਹੜਾ ਕਿ ਆਪਣੇ ਕਮਾਏ ਹੋਏ ਪੈਸੇ ਨੂੰ ਇਨਵੈਸਟ ਕਰਕੇ ਉਸ ਤੋਂ ਬੈਨੀਫਿਟ ਲੈਣਾ ਚਾਹੁੰਦਾ ਇਸ ਕਰਕੇ ਉਹ ਲੋਕਾਂ ਨੂੰ ਪ੍ਰਭਾਵਿਤ ਕਰਦਾ ਲੋਕਾਂ ਨੂੰ ਪ੍ਰਭਾਵਿਤ ਕਰਦਾ ਜੇ ਕੋਈ ਸਪੋਜ ਕਹਿ ਲਓ ਕਿ ਜਿਵੇਂ ਮੈਂ ਇੱਕ ਕਿਸੇ ਹੁਨਰ ਮੇਰੇ ਕੋਲ ਕੋਈ ਹੁਨਰ ਹੈ ਬਟ ਮੇਰੇ ਕੋਲ ਇਨਵੈਸਟ ਕਰਨ ਲਈ ਪੈਸਾ ਨਹੀਂ ਹੈਗਾ ਤਾਂ ਮੈਂ ਸ਼ਾਰਕ ਟੈਂਕ ਦੇ ਵਿੱਚ ਉਹਨਾਂ ਵਪਾਰੀਆਂ ਦੇ ਅੱਗੇ ਜਾ ਕੇ ਆਪਣਾ ਹੁਨਰ ਪੇਸ਼ ਕਰਾਂਗਾ ਆਪਣਾ ਜੋ ਮੈਨੂੰ ਕੁੱਝ ਆਉਂਦਾ ਹੈ ਮੈਂ ਉਹਦੇ ਲਈ ਉਹਨਾਂ ਨੂੰ ਦੱਸਾਂਗਾ ਕਿ ਮੈਂ ਅਗਰ ਇਹ ਬਿਜ਼ਨਸ ਕਰਦਾ ਹਾਂ ਤਾਂ ਮੈਨੂੰ ਸੱਠ ਸੱਤਰ ਪ੍ਰਸੈਂਟ ਜਾਂ ਪੰਜਾਹ ਪ੍ਰਸੈਂਟ ਦਾ ਪ੍ਰੋਫਿਟ ਹੁੰਦਾ ਤਾਂ ਉਹ ਮੈਂ ਮੈਂ ਅਗਰ ਉਹ ਪ੍ਰਭਾਵਿਤ ਹੋ ਜਾਂਦੇ ਹੈ ਤਾਂ ਉਹ ਫਿਰ ਮੇਰੇ ਉੱਤੇ ਪੈਸਾ ਇਨਵੈਸਟ ਕਰਦੇ ਆ ਅਤੇ ਮੈਂ ਉਸ ਪੈਸੇ ਨੂੰ ਯੂਜ ਕਰਕੇ ਆਪਣੇ ਹੁਨਰ ਨੂੰ ਉਹਦੇ ਨਾਲ ਯੂਜ ਕਰਕੇ ਉਸ ਬਿਜਨਸ ਨੂੰ ਕਰਦਾ ਹਾਂ ਅਤੇ ਉਸ ਵਿੱਚ ਜਿਹੜੀ ਮੈਨੂੰ ਗਰੋਥ ਮਿਲਦੀ ਹੈ ਅਗਰ ਮੈਨੂੰ ਕੋਈ ਪ੍ਰੋਫਿਟ ਹੁੰਦਾ ਹੈ ਤਾਂ ਸ਼ਾਰਕ ਟੈਂਕ ਦੇ ਵਿੱਚ ਜਿਹੜੇ ਬਿਜ਼ਨਸਮੈਨ ਨੂੰ ਮੈਨੂੰ ਪ੍ਰੈਫਰੈਂਸ ਦਿੰਦੇ ਨੇ ਜਾਂ ਮੇਰੇ ਉੱਤੇ ਪੈਸਾ ਇਨਵੈਸਟ ਕਰਦੇ ਨੇ ਤਾਂ ਉਹ ਆਪਣਾ ਕਮਿਸ਼ਨ ਜਿਹੜਾ ਮਿਥਿਆ ਹੁੰਦਾ ਉਹ ਲੈ ਲੈਂਦੇ ਨੇ ਜਿਸ ਦੀ ਵਜ੍ਹਾ ਕਰਕੇ ਇਹ ਕਾਫੀ ਮਸ਼ਹੂਰ ਵੀ ਹੋ ਗਿਆ ਅਤੇ ਲੋਕ ਵੀ ਕਾਫੀ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਇਸ ਬਿਜ਼ਨਸ ਤੋਂ ਅਤੇ ਇਸ ਦੀ ਐਡ ਵੀ ਉਸ ਤੋਂ ਬਾਅਦ ਕਾਫੀ ਹੋ ਚੁੱਕੀ ਹੈ ਅਤੇ ਇਹ ਇੱਕ ਨੋਰਮਲ ਆਦਮੀ ਨੂੰ ਗਰੋਥ ਦੇਣ ਲਈ ਅਤੇ ਸ਼ਾਰਕ ਟੈਂਕ ਦੇ ਜਿਹੜੇ ਬਿਜਨਸਮੈਨ ਨੇ ਉਹ ਆਪਣੇ ਪੈਸੇ ਤੋਂ ਪ੍ਰੋਫਿਟ ਲੈਣ ਲਈ ਇਸ ਨੂੰ ਚਲਾਉਂਦੇ ਨੇ ਅਤੇ ਉਹ ਕਾਫੀ ਬੈਨੀਫਿਟ ਦੇ ਵਿੱਚ ਜਾ ਰਿਹਾ ਮੇਰੀ ਇਹ ਸੋਚ ਹੈ